ਭਾਰਤ ਦੀਆਂ ਸਰਕਾਰੀ ਭਾਸ਼ਾਵਾਂ ਤਾਂ ਪੰਜ ਸੌ ਦੇ ਕਰੀਬ ਹੈ ਅਤੇ ਦੇਸ਼ ਵਿੱਚ ਆਮ ਬੋਲੀ ਜਾਣ ਵਾਲੀਆਂ ਜਿਹੜੀਆਂ ਭਾਸ਼ਾਵਾਂ ਹੈਗੀਆਂ ਉਹ ਸਿਰਫ਼ ਜ਼ਿਆਦਾ ਹਿੰਦੀ ਓ ਹੈ ਕਿ ਹਿੰਦੀ ਇੱਕ ਤਾਂ ਸਾਡੀ ਰਾਸ਼ਟਰੀ ਭਾਸ਼ਾ ਹੈਗੀ ਹੈ ਅਤੇ ਸਾਰੇ ਲੈਵਲ 'ਤੇ ਇਹ ਬੋਲੀ ਜਾਂਦੀ ਉਸ ਤੋਂ ਬਾਅਦ ਆਉਂਦੀ ਹੈ ਇੰਗਲਿਸ਼ ਜਿਹੜੀ ਕਿ ਤੁਹਾਨੂੰ ਦੂਸਰੇ ਦੇਸ਼ਾਂ 'ਚ ਵੀ ਅ ਬੋਲਣ 'ਚ ਜਾਂ ਦੂਸਰੇ ਦੇਸ਼ਾਂ ਨਾਲ ਕੰਟੈਕਟ ਕਰਨ ਵਾਸਤੇ ਤੀਸਰੀ ਅ ਦੂਸਰੀ ਇਹ ਲੈਂਗੁਏਜ ਹੈਗੀ ਕਿ ਜਿਹੜੀ ਜ਼ਿਆਦਾ ਬੋਲੀ ਜਾਂਦੀ ਹੈ ਇੰਟਰਨੈਸ਼ਨਲ ਲੈਵਲ ਦੇ ਤੌਰ 'ਤੇ ਪਰ ਸਾਡੇ ਦੇਸ਼ 'ਚ ਤਾਂ ਹਰ ਪ੍ਰਾਂਤ ਦੀ ਅਲੱਗ ਅਲੱਗ ਭਾਸ਼ਾ ਹੈਗੀ ਆ ਤੁਸੀਂ ਲੁਧਿਆਣੇ ਤੱਕ ਜਾਓ ਤਾਂ ਉਹਨਾਂ ਦੇ ਵੀ ਕਈ ਵਰਡ ਤੁਹਾਡੇ ਨਾਲ ਨਹੀਂ ਮਿਲਦੇ ਉਹ ਸਿੱਟ ਚੱਕ ਇਸ ਤਰਾਂ ਕਰਦੇ ਹੈ ਅਤੇ ਉਹ ਵੈਸੇ ਇਹ ਹੈ ਕਿ ਸਾਡੀ ਪੰਜਾਬੀ ਭਾਸ਼ਾ ਮਿਲਦੀ ਹੈ ਉਹਨਾਂ ਨਾਲ ਅਤੇ ਆ ਥੋੜ੍ਹੇ ਕੁ ਵਰਡ ਹੈਗੇ ਆ ਜਿਹੜੇ ਕਿ ਵਿਭਿੰਨ ਹੈਗੇ ਹੈ ਥੋੜ੍ਹੇ ਕਿ ਉਹਨਾਂ ਦਾ ਬੋਲਣ ਦਾ ਐਂਸਟ ਥੋੜ੍ਹਾ ਅਲੱਗ ਹੈ ਅਤੇ ਕੁਛ ਵਰਡ ਹੈਗੇ ਹੈ ਤੇ ਪਰ ਸਭ ਤੋਂ ਜ਼ਿਆਦਾ ਇੱਕ ਹਿੰਦੀ ਹੈ ਸਾਨੂੰ ਜਿਹੜੀ ਜੋੜ ਦਿੰਦੀ ਹੈ ਹੋਰ ਪ੍ਰਾਂਤਾਂ ਨਾਲ ਵੈਸੇ ਤਾਂ ਤੁਹਾਨੂੰ ਸਾਰ ਤਾਂ ਪਤਾ ਕਿ ਸਾਡਾ ਦੇਸ਼ ਹੈਗਾ ਹੀ ਵਿਭਿੰਨਤਾਵਾਂ ਦਾ ਵੱਖਰੀ ਵੱਖਰੀ ਭਾਸ਼ਾਵਾਂ ਵਾਲਾ ਦੇਸ਼ ਹੈਗਾ ਹੈ ਅਤੇ ਵੱਖਰੇ ਵੱਖਰੇ ਹੀ ਲੋਕ ਆ ਅਤੇ ਵੱਖਰੇ ਵੱਖਰੇ ਪ੍ਰਾਂਤ ਹੈ ਪਰ ਫਿਰ ਵੀ ਹਿੰਦੀ ਇੱਕ ਜਿਹੜੀ ਹੈ ਐਸੀ ਭਾਸ਼ਾ ਹੈਗੀ ਹੈ ਇੰਗਲਿਸ਼ ਐਸੀ ਭਾਸ਼ਾ ਹੈਗੀ ਆ ਜਿਹੜੀ ਇੱਕ ਦੂਸਰੇ ਨੂੰ ਬੰਨਦੀ ਹੈ ਆਪਸ 'ਚ ਫਿਰ ਵੀ ਗੱਲ ਕਰਨ ਦੇ ਅਸੀਂ ਇੱਕ ਦੂਸਰੇ ਨੂੰ ਦੋ ਯੋਗ ਹੁੰਦੇ ਹਾਂ ਅਤੇ ਫਿਰ ਸਾਡੇ ਪਰ ਇੰਗਲਿਸ਼ ਇੰਨੀ ਜ਼ਿਆਦਾ ਨਹੀਂ ਹੈਗੀ ਮਹਾਰਤ ਅਸੀਂ ਹਾਸਲ ਕੀਤੀ ਹੋਈ ਅਸੀਂ ਉਹ ਫਿਰ ਬਾਹਰ ਜਾਣਾ ਹੋਵੇ ਤਾਂ ਸਾਨੂੰ ਆਈਲੈਟਸ ਵਗੈਰਾ ਕਰਨਾ ਹੀ ਪੈਂਦੇ ਉਹ ਇੰਗਲਿਸ਼ ਉਹਨਾਂ ਦੇ ਲੈਵਲ ਦੀ ਉਹਨਾਂ ਦੇ ਐਂਸਟ ਦੀ ਸਾਨੂੰ ਸਿਖਣੀ ਪੈਂਦੀ ਹੈ ਤਾਂ ਕਿ ਅਸੀਂ ਉੱਥੇ ਜਾ ਕੇ ਉਹਨਾਂ ਨੂੰ ਕੁਛ ਬੋਲ ਤਾਂ ਸਕੀਏ ਜੇ ਬਾ ਅਸੀਂ ਬੋਲ ਬੋਲ ਰਹੀ ਓ ਤਾਂ ਅਸੀਂ ਇੱਕ ਦੂਸਰੇ ਨਾਲ ਕਮਿਊਨੀਕੇਟ ਕਰਾਂਗੇ ਅਤੇ ਜੇ ਸਾਡੀ ਲੈਂਗੁਏਜ ਏ ਨਹੀਂ ਠੀਕ ਹੋਏਗੀ ਅਸੀਂ ਕਮਿਊਨੀਕੇਟ ਕਰ ਹੀ ਨਹੀਂ ਸਕਦੇ ਲੈਂਗੁਏਜ ਸਾਰੀਆਂ ਆਉਣੀਆਂ ਜ਼ਰੂਰੀ ਤਾਂ ਹੁੰਦੀਆਂ ਪਰ ਫਿਰ ਵੀ ਇੱਕ ਲੈਂਗੁਏਜ 'ਚ ਤੁਸੀਂ ਮਹਾਰਤ ਹਾਸਲ ਕਰੋ